ਹਾਂ ਨਮਸਕਾਰ ਜੀ ਤੁਸੀਂ ਸਟੇਟ ਬੈਂਕ ਤੋਂ ਮੈਨੇਜਰ ਵਿਜੈ ਪ੍ਰਵੀਨ ਜੀ ਬੋਲ ਰਹੇ ਓ ਹਾਂ ਸਰ ਇਸ ਤਰਾਂ ਸੀ ਕਿ ਮੈਂ ਤੁਹਾਡੇ ਇੱਕ ਬੈਂਕ ਇਮਪਲੋਈ ਦੀ ਕੰਪਲੇਂਟ ਕਰਨੀ ਸੀ ਮੈਂ ਐਕਚੁਲੀ ਦੁਪਹਿਰੇ ਆਈ ਸੀ ਬੈਂਕ 'ਚ ਮੈਂ ਉਹਦਾ ਡਰਾਫਟ ਦਾ ਕੁਝ ਪੁੱਛਣਾ ਸੀਗਾ ਤੇ ਬੁਲਾਇਆ ਸੀ ਉਹਨਾਂ ਨੇ ਇਮਪਲੋਈ ਹੈਗੇ ਨੇ ਅਨਿਲ ਹੈਗੇ ਨੇ ਓਥੇ ਅਨਿਲ ਸ਼ਰਮਾ ਸ਼ਾਇਦ ਦਾ ਨਾਮ ਉਹਨਾਂ ਦਾ ਤੇ ਉਹਨਾਂ ਨੂੰ ਪੁੱਛਿਆ ਵੀ ਇਹ ਡਰਾਫਟ ਦਾ ਕਿਸ ਤਰ੍ਹਾਂ ਕਦੋਂ ਤੱਕ ਪੇਮੈਂਟ ਹੋ ਜਾਏਗੀ ਯਾ ਕੀ ਮਤਲਬ ਇਸ ਬਾਰੇ ਕੁਝ ਜਾਣਕਾਰੀ ਦੇ ਦਿਓ ਮੈਨੂੰ ਉਹ ਕਹਿੰਦੇ ਮੈਮ ਤੁਸੀਂ ਆਣਾ ਅੱਧੇ ਘੰਟੇ ਬਾਅਦ ਆਣਾ ਮੇਰੇ ਕੋਲ ਤਾਂ ਟਾਈਮ ਨਹੀਂ ਹੈਗਾ ਇਸ ਵੇਲੇ ਹੁਣ ਇਸ ਤਰ੍ਹਾਂ ਥੋੜੀ ਹੁੰਦਾ ਵੀ ਕੋਈ ਕਸਟਮਰ ਜਾਏ ਉਥੇ ਤੇ ਇਦਾਂ ਥੋੜੀ ਹੁੰਦਾ ਘੰਟੇ ਬਾਅਦ ਦੁਬਾਰਾ ਆਏ ਫਿਰ ਦੁਬਾਰਾ ਆਏ ਇਹ ਤਾਂ ਕੋਈ ਤਰੀਕਾ ਨਹੀਂ ਨਾ ਗੱਲ ਕਰਨ ਦਾ ਹਾਂਜੀ ਹਾਂਜੀ ਆਏ ਤਾਂ ਹੈ ਵੀ ਤੁਸੀਂ ਬੈਂਕ ਦੇ ਤੁਹਾਡੇ ਕਸਟਮਰ ਇਦਾਂ ਤਾਂ ਕਸਟਮਰ ਵੀ ਡਿਸਆਰਡਰ ਹੋ ਜਾਂਦੇ ਨੇ ਅਸੀਂ ਤੁਹਾਡੇ

ਹਾਂ ਤੇ ਇਹ ਤਾਂ ਦਿੱਕਤ ਐ ਨਾ ਤੇ ਅਸੀਂ ਤੁਹਾਡੇ ਡੀਲ ਹੀ ਨਹੀਂ ਕਰਾਂਗੇ ਤੁਹਾਡੇ ਬੈਂਕ ਨਾਲ ਜੇ ਐਸ ਤਰਾਂ ਬਦਤਮੀਜ਼ੀ ਕਰੇਗਾ ਤਾਂ ਐਂ ਸਿਰਫ ਮੈਂ ਇਸ ਤਰ੍ਹਾਂ ਨਹੀਂ ਬਈ ਕੱਲ ਹੀ ਹੋਇਆ ਇੱਕ ਵਾਰੀ ਅੱਗੇ ਵੀ ਇਸੇ ਤਰ੍ਹਾਂ ਆਏ ਤੇ ਮੈਨੂੰ ਲੱਗਦਾ ਇਹੀ ਇਮਪਲੋਈ ਸੀ ਅੱਗੇ ਵੀ ਉਹਨਾਂ ਨੇ ਕੁਝ ਇਸ ਤਰ੍ਹਾਂ ਕੀਤਾ ਸੀਗਾ

ਹਾਂ ਅੱਗੇ ਤਾਂ ਮੈਂ ਚਲੋ ਕੀਤਾ ਮੈਂ ਕਿਹਾ ਸ਼ਾਇਦ ਫਸਟ ਟਾਈਮ ਤੇ ਨਹੀਂ ਠੀਕ ਲੱਗਦਾ ਇਸ ਤਰ੍ਹਾਂ ਲੇਕਿਨ ਕੱਲ ਫਿਰ ਉਹੀ ਹੋਇਆ ਉਸੇ ਤਰਾਂ ਹੀ ਹੋਇਆ ਇਸੇ ਕਰਕੇ ਨਾ ਇਸੇ ਕਰਕੇ ਪਹਿਲੀ ਵਾਰੀ ਨਹੀਂ ਕੀਤਾ ਮੈਂ ਚਲੋ ਚਲੋ ਠੀਕ ਚਲੋ ਠੀਕ ਹ ਜੀ ਮੈਂ ਹਾਂ ਕੱਲ ਕੋਸ਼ਿਸ਼ ਕਰਕੇ ਹਾਂਜੀ ਕੱਲ ਟਾਈਮ ਨਿਕਾਲ ਕੇ ਆਨੀ ਹ ਮੈਂ ਥੈਂਕਯੂ ਜੀ ਸ਼ੁਕਰੀਆ ਓਕੇ